ਸਾਡੀ ਰਸੋਈ ਵਿੱਚ ਬਿਜਲੀ ਦੇ ਕਈ ਉਪਕਰਣ ਹਨ ਜਿਹਨਾਂ ਵਿੱਚੋਂ ਕਿ ਇੱਕ ਫਰਿੱਜ ਫਰਿੱਜ ਦੇ ਵਿੱਚ ਤੁਸੀਂ ਅੱਜ ਦਾ ਨਵਾਂ ਚੋਇਆ ਹੋਇਆ ਦੁੱਧ ਰੱਖ ਦਿਉ ਪਹਿਲਾਂ ਪੁਰਾਣੇ ਸਮਿਆਂ ਵਿੱਚ ਰੱਖਦੇ ਸੀਗੇ ਲੋਕ ਉਬਾਲ ਕੇ ਰੱਖ ਦਿੰਦੇ ਸੀ ਅਤੇ ਉਹ ਇੱਕ ਦਿਨ ਕੱਢਦਾ ਸੀ ਅੱਜ ਦੇ ਸਮੇਂ ਵਿੱਚ ਜੇ ਤੁਸੀਂ ਫਰਿੱਜ 'ਚ ਦੁੱਧ ਰੱਖਦੇ ਹੋ ਤਾਂ ਉਹ ਦੋ ਦਿਨ ਤਿੰਨ ਦਿਨ ਕੱਢ ਦਿੰਦਾ ਆਰਾਮ ਨਾਲ ਉਹ ਖਰਾਬ ਨਹੀਂ ਹੋਏਗਾ ਪੁਰਾਣੇ ਸਮਿਆਂ 'ਚ ਲੋਕ ਘੜੇ ਦਾ ਪਾਣੀ ਪੀਂਦੇ ਸੀ ਜੋ ਕਿ ਬਹੁਤ ਹੀ ਸਹੀ ਹੁੰਦਾ ਸੀ ਠੀਕ ਸਿਹਤ ਵਾਸਤੇ ਵੀ ਠੀਕ ਹੁੰਦਾ ਸੀ ਮਿਨਰਲ ਪੂਰੇ ਹੁੰਦੇ ਸੀ ਓਹਦੇ ਵਿੱਚ ਅੱਜ ਕੱਲ ਲੋਕ ਫਿਲਟਰ ਯੂਸ ਕਰਦੇ ਆ ਉਹਦੇ ਨਾਲ ਜਿਵੇਂ ਕਿ ਗੋਡਿਆਂ ਦੀ ਬਿਮਾਰੀ ਲੀਵਰ ਦੀ ਬਿਮਾਰੀ ਬਹੁਤ ਜ਼ਿਆਦਾ ਬਿਮਾਰੀਆਂ ਸਾਨੂੰ ਹੀ ਸਰੀਰ ਨੂੰ ਲੱਗ ਰਹੀਆਂ ਹਨ ਪੁਰਾਣੇ ਸਮਿਆਂ ਵਿੱਚ ਘੜੇ ਦੇ ਵਿੱਚ ਲੱਕੜ ਦੀ ਮਧਾਣੀ ਪਾ ਕੇ ਰਿੜਕੀ ਜਾਂਦੀ ਸੀ ਅੱਜ ਦੇ ਸਮੇਂ ਵਿੱਚ ਇੱਕ ਲੋਹੇ ਦਾ ਲੋਹੇ ਦੀ ਮਧਾਣੀ ਜੋ ਕਿ ਬਿਜਲੀ ਨਾਲ ਚਲਦੀ ਹੈ ਉਹ ਯੂਸ ਕਰੀ ਜਾਂਦੀ ਹੈ ਜੋ ਕਿ ਸਿਹਤ ਵਰਧਕ ਨਹੀਂ ਹੈ